ਹਰੇਕ ਰਾਜ ਵਿੱਚ ਆਪਣਾ ਵੱਖਰਾ ਵੱਖਰਾ ਕਲਾ ਦਾ ਰੂਪ ਹੁੰਦਾ ਅਤੇ ਇਹਨਾਂ ਦਾ ਵੱਖਰਾ ਵੱਖਰਾ ਹੀ ਓਹਨਾਂ ਵਿੱਚ ਵਿਕਾਸ ਹੁੰਦਾ ਇਹਨਾਂ ਵਿੱਚ ਕਾਫੀ ਪਰਿਵਰਤਨ ਵੀ ਆਉਂਦੇ ਨੇਗੇ ਆਉਣ ਵਿੱਚ ਕਿਉਂਕਿ ਇਹ ਅੰਤਰ ਰਾਸ਼ਟਰੀ ਵੀ ਹੁੰਦੇ ਨੇ ਅਤੇ ਰਾਸ਼ਟਰੀ ਰੁਝਾਨ ਵੀ ਹੁੰਦੇ ਨੇਗੇ ਇਹ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇਗੇ ਇਹਨਾਂ ਨੂੰ ਸਿੱਖਣ ਲਈ ਅਸੀਂ ਸ਼ੋਸ਼ਲ ਮੀਡੀਆ ਸਭ ਤੋਂ ਵੱਡਾ ਪਲੈਟਫਾਰਮ ਹੈ ਜਿਹ ਤੋਂ ਅਸੀਂ ਆਰਟ ਐਂਡ ਕਰਾਫਟ ਬਾਰੇ ਸਿੱਖ ਸਕਦੇ ਹਾਂ ਕਿਉਂਕਿ ਇਹ ਸਾਨੂੰ ਬਹੁਤ ਹੀ ਵਧੀਆ ਸਿਖਲਾਈ ਦਿੰਦੇ ਨੇ ਇਹਨਾਂ 'ਤੇ ਸਾਡਾ ਕੋਈ ਪੈਸਾ ਵੀ ਖਰਚ ਨਹੀਂ ਹੁੰਦਾ ਹੈਗਾ ਇਹ ਸਾਨੂੰ ਵਧੀਆ ਤਰੀਕੇ ਨਾਲ ਕੀ ਹੈ ਜਿਹੜਾ ਸਾਰੇ ਸਾਰੀਆਂ ਚੀਜ਼ਾਂ ਅਤੇ ਕਲਾ ਬਾਰੇ ਸਾਨੂੰ ਵਧੀਆ ਗਿਆਨ ਦਵਾਂਦੇ ਨੇਗੇ ਕਲਾ ਅਸੀਂ ਕਿਹੜੀ ਵੀ ਤਰੀਕੇ ਦੀ ਕਲਾ ਸਿੱਖ ਸਕਦੇ ਹਾਂ ਨ੍ਰਿਤ ਕਲਾ ਸੰਗੀਤ ਕਲਾ ਨਾ ਆਰਟ ਐਂਡ ਕਰਾਫਟ ਕੋਈ ਵੀ ਕਾਫੀ ਚੀਜ਼ਾਂ ਅਸੀਂ ਨੈੱਟ ਤੋਂ ਹੀ ਸਿੱਖ ਸਕਦੇ ਹਾਂ